ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਗਗਨਦੀਪ ਸਿੰਘ ਗੱਲ ਕਰ ਰਿਹਾ ਜੀ ਭਾਅ ਜੀ ਤੁਹਾਡੇ ਰੀਤ ਟਰੈਵਲ ਤੋਂ ਆਪਾਂ ਕੈਬ ਬੁੱਕ ਕੀਤੀ ਸੀ ਹਿਮਾਚਲ ਘੁੰਮਣ ਲਈ ਅਤੇ ਆਪਣੀ ਗੱਲ ਦਸ ਹਜ਼ਾਰ ਵਿੱਚ ਫਿਕਸ ਹੋਈ ਸੀ ਕਿ ਆਪਾਂ ਚਾਰ ਦਿਨ ਘੁੰਮਣਾ ਹੈ ਅਤੇ ਕੈਬ ਤੁਹਾਡੀ ਲੈ ਕੇ ਜਾਣੀ ਹੈ ਪਰ ਜਦੋਂ ਆਪਾਂ ਹੁਣ ਡਰਾਇਵਰ ਨੂੰ ਪੇਮੈਂਟ ਕਰਨ ਲੱਗਿਆ ਤਾਂ ਡਰਾਇਵਰ ਦਸ ਹਜ਼ਾਰ ਦੀ ਜਗ੍ਹਾ ਤੇਰ੍ਹਾਂ ਹਜ਼ਾਰ ਮੰਗ ਰਿਹਾ ਹੈ ਸੋ ਤੁਸੀਂ ਡਰਾਇਵਰ ਨਾਲ ਗੱਲ ਕਰੋ ਜਾਂ ਦੱਸੋ ਮੈਂ ਇਹਨੂੰ ਕਿੰਨੇ ਪੈਸੇ ਦੇਵਾਂ ਕਿਉਂਕਿ ਲੋੜ ਤੋਂ ਵੱਧ ਪੈਸੇ ਮੰਗਦਾ ਹੈ ਜਿੰਨੀ ਆਪਣੀ ਗੱਲ ਹੋਈ ਸੀ ਜਾਂ ਤਾਂ ਤੁਸੀਂ ਡਰਾਇਵਰ ਨਾਲ ਗੱਲ ਕਰ ਲਉ ਜਾਂ ਫਿਰ ਮੈਂ ਪੈਸੇ ਦਾ ਜੋ ਲੈਣ ਦੇਣ ਹੈ ਉਹ ਤੁਹਾਡੀ ਕੰਪਨੀ ਦੇ ਦਫਤਰ ਆ ਕੇ ਕਰਾਂਗਾ ਠੀਕ ਆ ਜੀ ਧੰਨਵਾਦ